ਹੈਲੋ ਮੈਂ ਜਗਦੀਸ਼ ਕੁਮਾਰੀ ਬੋਲ ਰਹੀ ਹਾਂ ਗੁਰਦਾਸਪੁਰ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਭਾਂਡਿਆਂ ਬਾਰੇ ਸਾਡੇ ਸਥਾਨ ਦੇ ਮੂਲ ਰੂਪ ਵਿੱਚ ਮਿੱਟੀ ਦੇ ਭਾਂਡੇ ਅਤੇ ਪਿੱਤਲ ਦੇ ਭਾਂਡੇ ਸ਼ਾਮਲ ਹਨ ਜੋ ਕਿ ਸਾਡੇ ਸੱਭਿਆਚਾਰ ਦੇ ਨਾਲ ਜੁੜੇ ਹਨ ਕੁੜੀਆਂ ਮਿੱਟੀ ਦੇ ਘੜੇ ਉੱਪਰ ਰੰਗ ਨਾਲ ਫੁੱਲ ਅਤੇ ਲੀਕਾਂ ਪਾ ਕੇ ਪੇਂਟਿੰਗ ਕਰਦੀਆਂ ਸਨ ਜੋ ਕਿ ਅੱਜ ਦੇ ਸਮੇਂ ਵਿੱਚ ਨਾ ਮਾਤਰ ਵੇਖਣ ਨੂੰ ਮਿਲਦਾ ਹੈ ਪੁਰਾਣੇ ਸਮੇਂ ਵਿੱਚ ਜਦੋਂ ਮਿੱਟੀ ਦੇ ਘਰ ਹੁੰਦੇ ਸਨ ਉਸ ਵੇਲੇ ਔਰਤਾਂ ਗੋਹਾ ਅਤੇ ਮਿੱਟੀ ਮਿਲਾ ਕੇ ਸਪਲਾਈ ਸਫਾਈ ਕਰਦੀਆਂ ਸਨ ਅਤੇ ਉਸ ਉੱਪਰ ਪੋਚਾ ਵੀ ਫੇਰ ਦਿੰਦੀਆਂ ਸਨ ਜਿਸ ਨਾਲ ਘਰ ਲਿਸ਼ਕਦੇ ਹੁੰਦੇ ਹਨ ਅਤੇ ਬਹੁਤ ਹੀ ਵਧੀਆ ਲੱਗਦਾ ਸੀ ਅੱਜ ਕੱਲ੍ਹ ਦੇ ਸਮੇਂ ਵਿੱਚ ਤਾਂ ਇਹ ਸਭ ਕੁਛ ਦੇਖਣ ਨੂੰ ਨਹੀਂ ਮਿਲਦਾ ਉਸ ਵੇਲੇ ਤਾਂ ਇਹ ਪਿਛਲੇ ਸਮੇਂ ਵਿੱਚ ਤਾਂ ਇਹ ਚੀਜ਼ਾਂ ਬਹੁਤ ਹੀ ਮਾਇਨੇ ਰੱਖਦੀਆਂ ਸਨ ਹੁਣ ਇਹ ਚੀਜ਼ਾਂ ਦਾ ਕੋਈ ਇਸਤੇਮਾਲ ਨਹੀਂ ਕਰਦਾ